ਅਸੀਂ ਇਸ ਵਾਰ ਛੁੱਟੀਆਂ ਦੇ ਵਿੱਚ ਸ਼ਿਮਲੇ ਟੋਆਏ ਟ੍ਰੇਨ ਵਿੱਚ ਘੁੰਮਣਾ ਜਾਣ ਲਈ ਜਾਣਾ ਚਾਹੁੰਦੇ ਹਾਂ ਜੋ ਕਿ ਉਸਦੀ ਟ੍ਰੇਨ ਦੀ ਬੁਕਿੰਗ ਲਈ ਅਸੀਂ ਏਜੰਟ ਨੂੰ ਮਿਲੇ ਤਾਂ ਉਹਨਾਂ ਨੇ ਦੱਸਿਆ ਵੀ ਉਹਦੀ ਤਾਂ ਟਿਕਟ ਮਿਲ ਨਹੀਂ ਰਹੀ ਤਿੰਨ ਤਿੰਨ ਮਹੀਨੇ ਦੀ ਉਹਦੀ ਬੁਕਿੰਗ ਹੈ ਪਰ ਬੱਚੇ ਇਹ ਜਿੱਦ ਕਰ ਰਹੇ ਆ ਕਿ ਅਸੀਂ ਟੋਆਏ ਟ੍ਰੇਨ ਵਿੱਚ ਹੀ ਘੁੰਮਣ ਜਾਣਾ ਹੈ ਜਦੋਂ ਕਿ ਸਾਡੇ ਕੋਈ ਨੋਨ ਵਿੱਚ ਗਿਆ ਸੀ ਉਹਨਾਂ ਨੇ ਸਾਨੂੰ ਦੱਸਿਆ ਵੀ ਟੋਆਏ ਟ੍ਰੇਨ ਬਹੁਤ ਹੀ ਵਧੀਆ ਹੈ ਛੋਟੀ ਜਿਹੀ ਹ ਬਹੁਤ ਮਜ਼ੇਦਾਰ ਸਫਰ ਹੈ ਟੋਆਏ ਟਰੇਨ ਦਾ ਇਸ ਲਈ ਬੱਚਿਆਂ ਨੂੰ ਇਹ ਹੀ ਹੋਇਆ ਹੈ ਵੀ ਅਸੀਂ ਟੋਆਏ ਟ੍ਰੇਨ ਵਿੱਚ ਹੀ ਘੁੰਮਣ ਜਾਣਾ ਹੈ ਜਿਸ ਵਜ੍ਹਾ ਨਾਲ ਅਸੀਂ ਏਜੈਂਟ ਨਾਲ ਗੱਲ ਕਰਦੇ ਪਏ ਹਾਂ ਵੀ ਜਿੱਦਾਂ ਵੀ ਹੋ ਸਕਦਾ ਵਾ ਸਾਨੂੰ ਉਸਦੀ ਟਿਕਟ ਦੀ ਬੁਕਿੰਗ ਜ਼ਰੂਰ ਕਰਵਾ ਕੇ ਦੇਵੋ